ਮਨੋਰੰਜਨ ਉਦਯੋਗ ਵਿੱਚ ਖੇਡਣ ਦੀ ਬਹੁਤ ਭੂਮਿਕਾ ਟੀ ਵੀ ਸੋਸ਼ਲ ਮੀਡੀਆ ਟਵਿੱਟਰ ਯੂਟਿਊਬ ਇਸ ਤਰ੍ਹਾਂ ਯੂਟਿਊਬ 'ਤੇ ਚੈਨਲ ਛੋਟੇ ਚੈਨਲ ਵੱਡੇ ਚੈਨਲ ਇਹ ਤਾਂ ਹੀ ਚੱਲਣਗੇ ਜੇ ਖੇਡਾਂ ਨੇ ਖੇਡਾਂ ਨੂੰ ਇਹਨਾਂ ਚੈਨਲਸ ਦੇ ਉੱਤੇ ਦਿਖਾਇਆ ਜਾਵੇਗਾ ਸਪੋਰਟਸ ਪੂਰੀ ਦੁਨੀਆਂ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਇੰਡਸਟਰੀ ਇਸ ਤਰ੍ਹਾਂ ਦੀ ਵੱਡੀ ਇੰਡਸਟਰੀ ਹੈ ਜੋ ਕਿ ਪੂਰੀ ਦੁਨੀਆ ਦਾ ਫੋਕਸ ਇਹਦੇ ਉੱਤੇ ਹਰ ਵਕਤ ਲੱਗਿਆ ਰਹਿੰਦਾ ਹੈ ਪੂਰੀ ਦੁਨੀਆਂ ਦੇ ਵਿੱਚ ਕਿਉਂਕਿ ਕਿਤੇ ਦਿਨ ਹੈ ਕਿਤੇ ਰਾਤ ਹੈ ਇਸ ਤਰ੍ਹਾਂ ਜਿੱਥੇ ਦਿਨ ਹੈ ਉੱਥੇ ਦਿਨ ਵਾਲੀਆਂ ਖੇਡਾਂ ਜਿੱਥੇ ਰਾਤ ਹੈ ਉੱਥੇ ਰਾਤ ਵਾਲੀਆਂ ਖੇਡਾਂ ਖੇਡੀਆਂ ਜਾਂਦੀਆਂ ਨੇ ਉਹਨਾਂ ਨੂੰ ਫਿਰ ਪੂਰੀ ਦੁਨੀਆਂ 'ਚ ਦਿਖਾਇਆ ਜਾਂਦਾ ਹੈ ਇਹ ਖੇਡਾਂ ਜਿਸ ਤਰ੍ਹਾਂ ਹੁਣ ਕ੍ਰਿਕੇਟ ਹੈ ਕ੍ਰਿਕੇਟ ਅੱਧੀ ਰਾਤ ਵੀ ਚੱਲੀ ਜਾਂਦੀ ਹੈ ਦਿਨੇ ਵੀ ਚੱਲੀ ਜਾਂਦੀ ਹੈ ਇਸ ਤਰ੍ਹਾਂ ਹਾਕੀ ਹੈ ਹਾਕੀ ਰਾਤ ਨੂੰ ਦਸ ਵਜੇ ਤੱਕ ਚੱਲੀ ਜਾਂਦੀ ਹੈ ਅਤੇ ਇਸ ਤਰ੍ਹਾਂ ਅਥਲੈਟਿਕਸ ਹੈ ਅਥਲੈਟਿਕਸ ਰਾਤ ਨੂੰ ਦ ਦੋ ਦੋ ਵਜੇ ਤੱਕ ਚੱਲਦੀ ਹੈ ਤਾਂ ਉਹ ਉਸ ਨੂੰ ਪੂਰੀ ਦੁਨੀਆਂ 'ਚ ਦਿਖਾਉਣ ਵਾਸਤੇ ਮਨੋਰੰਜਨ ਭਾਵ ਕਿ ਇਹ ਚੈਨਲਾਂ ਦੀ ਜ਼ਰੂਰਤ ਪੈਂਦੀ ਹੈ ਇਹ ਚੈਨਲ ਚਾਹੇ ਯੂਟੀਊਬ 'ਤੇ ਹੋਣ ਚਾਹੇ ਮੇਨ ਚੈਨਲ ਹੋਣ ਚਾਹੇ ਸੋਸ਼ਲ ਮੀਡੀਆ ਹੋਵੇ ਫੇਸਬੁੱਕ ਹੋਵੇ ਟਵਿੱਟਰ ਹੋਵੇ ਉਹਦੇ ਦ ਉਹਦੇ ਰਾਹੀਂ ਪੂਰੀ ਦੁਨੀਆਂ ਦੇ ਵਿੱਚ ਇਹਨੂੰ ਫੈਲਾਇਆ ਜਾਂਦਾ ਹੈ ਦਿਖਾਇਆ ਜਾਂਦਾ ਹੈ ਇਸ ਦੇ ਦੌਰਾਨ ਜਦੋਂ ਇਸ 'ਚ ਪ੍ਰਸਾਰਿਤ ਕੀਤਾ ਜਾਂਦਾ ਹੈ ਇਸ ਗੇਮ ਨੂੰ ਕਿਸੇ ਵੀ ਖੇਡ ਨੂੰ ਤਾਂ ਉਹਦੇ ਵਿੱਚ ਕੁਛ ਵਕਫਾ ਮਿਲਦਾ ਟਾਇਮ ਮਿਲਦਾ ਕੁਛ ਉਹ ਟਾਈਮ ਦੇ ਦੌਰਾਨ ਜਿਹੜਾ ਮਨੋਰੰਜਨ ਜਗਤ ਹੈ ਉਹ ਆਪਣੀਆਂ ਮਸ਼ਹੂਰੀਆਂ ਵੀ ਦਿਖਾਉਂਦਾ ਮਸ਼ਹੂਰੀਆਂ ਦੇ ਨਾਲ ਪੂਰੀ ਦੁਨੀਆਂ ਦੇ ਵਿੱਚ ਜਿਹੜੀ ਐ ਐਡਵਰਟਾਈਜਮੈਂਟ ਜਿਹੜੀ ਮ ਮਨੋਰੰਜਨ ਹੈ ਜਿਹੜਾ ਮਨੋਰੰਜਨ ਦੀ ਮਨੋਰੰਜਨ ਰਾਹੀਂ ਪੈਸਾ ਬਹੁਤ ਲੱਗਦਾ ਇਹ ਵੀ ਇੱਕ ਅਲੱਗ ਇੰਡਸਟਰੀ ਪੈਦਾ ਹੋ ਗਈ ਦੁਨੀਆਂ ਦੇ ਵਿੱਚ ਕਿਸੇ ਵੀ ਵੱਡੀ ਇੰਡਸਟਰੀ ਨੇ ਜੇ ਆਪਣੀ ਕਿਸੇ ਵੀ ਜਿਹੜਾ ਪ੍ਰੋਡਕਟ ਹੈ ਕਿਸੇ ਵੀ ਆਪਣੇ ਪੈਦਾ ਕੀਤੇ ਹੋਏ ਸਮਾਨ ਦੀ ਜੇ ਕੋਈ ਮਸ਼ਹੂਰੀ ਕਰਨੀ ਹੈ ਤਾਂ ਉਹਨੂੰ ਉਸ ਤਰ੍ਹਾਂ ਨਾਲ ਉਹ ਉਸ ਤਰ੍ਹਾਂ ਦੇ ਸਮੇਂ ਦੀ ਲੋੜ ਪੈਂਦੀ ਹੈ ਜਦੋਂ ਪੂਰੀ ਦੁਨੀਆ ਇੱਕ ਫੋਕਸ ਕਰਕੇ ਇੱਕ ਟੱਕ ਇੱਕ ਇੱਕ ਟੱਕ ਦੇਖ ਰਹੀ ਹੋਵੇ ਤਾਂ ਉਦੋਂ ਉਦੋਂ ਉਸ ਇੱਕ ਟੱਕ ਸਮੇਂ ਦੇ ਦੌਰਾਨ ਹੀ ਜਿਹੜਾ ਟਾਈਮ ਮਿਲਦਾ ਉਹਦੇ ਦੌਰਾਨ ਹੀ ਉਹ ਮਸ਼ਹੂਰੀ ਦਿਖਾਉਂਦੇ ਨੇ ਜਦੋਂ ਉਹ ਮਸ਼ਹੂਰੀ ਦਿਖਾਈ ਜਾਂਦੀ ਹੈ ਤਾਂ ਲੋਕ ਫਿਰ ਉਹਨੂੰ ਅਗਲੇ ਜਿਹੜੀ ਗੇਮ ਜਿਹੜੀ ਖੇਡ ਹੈ ਉਹ ਖੇਡ ਨੂੰ ਪੂਰੀ ਮਤਲਬ ਆਪਣੀ ਪੂਰਾ ਉਸ ਨਾਲ ਦੇਖਣ ਵਾਸਤੇ ਉਹਦੀ ਫਿਰ ਵੇਟ ਕਰਦੇ ਨੇ ਉਹਦੀ ਉਡੀਕ ਕਰਦੇ ਨੇ ਤਾਂ ਉਹ ਜਦੋਂ ਉਹ ਜਿੰਨਾ ਚਿਰ ਉਹ ਮਸ਼ਹੂਰੀ ਦਿਖਾਈ ਜਾਂਦੀ ਹੈ ਤਾਂ ਉੰਨਾ ਚਿਰ ਉਹਦੀ ਵੇਟ ਕੀਤੀ ਜਾਂਦੀ ਹੈ ਉਹਦੀ ਉਹਦੀ ਉਡੀਕ ਕੀਤੀ ਜਾਂਦੀ ਹੈ ਤਾਂ ਫਿਰ ਇਸ ਕਰਕੇ ਜਿਹੜਾ ਖੇਡਾਂ ਦਾ ਅਤੇ ਮਨੋਰੰਜਨ ਦਾ ਆਪਸ ਮੇਂ ਬਹੁਤ ਵੱਡਾ ਰਿਸ਼ਤਾ ਹੈ ਜਿੱਡ ਜਿੱਡੇ ਵੀ ਵੱਡੇ ਜਿਹੜੇ ਟੀ ਵੀ ਕਲਾਕਾਰ ਹੋਏ ਨੇ ਜਿੰਨੇ ਵੀ ਵੱਡੇ ਫਿਲਮਾਂ ਦੇ ਵਿੱਚ ਜਿਹੜੇ ਹੀਰੋ ਨੇ ਜਾਂ ਹੀਰੋਇਨਾਂ ਨੇ ਉਹਨਾਂ ਦਾ ਅਗਾਂਹ ਖੇਡਾਂ ਵਾਲਿਆਂ ਨਾਲ ਬਹੁਤ ਸੰਬੰਧ ਹੈ ਜਿਵੇਂ ਕਿਸੇ ਦੀਆਂ ਸ਼ਾਦੀਆਂ ਉਹਨਾਂ ਨਾਲ ਹੋ ਗਈਆਂ ਉਹਨਾਂ ਨੇ ਵਿਆਹ ਕਰਵਾ ਲਏ ਕਿਉਂਕਿ ਜ ਕਿਉਂਕਿ ਅੱਜ ਕੱਲ੍ਹ ਜਿਹੜੀਆਂ ਗੇਮਾਂ ਨੇ ਜਿਹੜੀਆਂ ਖੇਡਾਂ ਨੇ ਉਹਦੇ 'ਚ ਪੈਸਾ ਬਹੁਤ ਆ ਗਿਆ ਇੰਡਸਟਰੀ ਸਾਰੀ ਖੇਡਾਂ ਦੇ ਨਾਲ ਜੁੜ ਗਈ ਤਾਂ ਪ ਜਿਹੜਾ ਸਮਾਨ ਹੈ ਖੇਡਾਂ ਦਾ ਉਹ ਵੀ ਇਸ ਤਰ੍ਹਾਂ ਦਾ ਪੈਦਾ ਹੋਣ ਲੱਗ ਗਿਆ ਵੀ ਪੂ ਮਤਲਬ ਇੱਕ ਦੇਸ਼ ਤੋਂ ਦੂਜੇ ਦੇਸ਼ ਤੋਂ ਤੀਜਾ ਦੇਸ਼ ਸਾਰੇ ਦੇਸ਼ਾਂ ਦੇ ਵਿੱਚ ਸਮਾਨ ਫੈਲਣ ਲੱਗ ਗਿਆ ਹੈ ਤਾਂ ਇਸ ਕਰਕੇ ਜਿਹੜਾ ਜਿਹੜਾ ਮਨੋਰੰਜਨ ਹੈ ਮਨੋਰੰਜਨ ਦਾ ਤੇ ਖੇਡਾਂ ਦਾ ਆਪਸ ਮੇਂ ਬਹੁਤ ਵੱਡਾ ਆਪਸ ਮੇਂ ਰਿਸ਼ਤਾ ਹੈਗਾ ਇਹ ਇਸ ਰਿਸ਼ਤੇ ਦੇ ਨਾਲ ਪੂਰੀ ਦੁਨੀਆ ਮਤਲਬ ਅੱਜ ਇਸ ਇਸ ਉਸ ਤੇ ਦੌਰਾਨ ਆਪਣਾ ਪੈਸਾ ਕਮਾ ਰਹੀ ਹੈ ਆਪਣਾ ਜਿਹੜਾ ਹੈਗਾ ਆਪਣੀਆਂ ਜਿਹੜੀਆਂ ਸਹੂਲਤਾਂ ਨੇ ਸੁੱਖ ਸਹੂਲਤਾਂ ਨੇ ਉਹਨਾਂ ਵਿੱਚ ਵਾਧਾ ਕਰ ਰਹੀ ਹੈ ਧੰਨਵਾਦ